ਮੇਰੇ ਖੇਤਰ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਦੁਖ ਨਿਵਾਰਨ ਸਾਹਿਬ ਹੈ ਜਿਸ ਦਾ ਇਤਿਹਾਸਕ ਅਤੇ ਧਾਰਮਿਕ ਮਹੱਤਵ ਹੈ ਇਸ ਗੁਰਦੁਆਰੇ ਦਾ ਸੰਬੰਧ ਸਿੱਖਾਂ ਦੇ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੈ ਮੰਨਿਆ ਜਾਂਦਾ ਹੈ ਕਿ ਉਰੇ ਸੱਚੇ ਮਨ ਨਾਲ ਕੋਈ ਵੀ ਅਰਦਾਸ ਕਰੇ ਅਤੇ ਇਸ਼ਨਾਨ ਕਰੇ ਤਾਂ ਉਸਦੀ ਅਰਦਾਸ ਸੁਣ ਲਈ ਜਾਂਦੀ ਹੈ ਅਤੇ ਉਸਦੇ ਦੁੱਖ ਕੱਟੇ ਜਾਂਦੇ ਹਨ ਮੈਂ ਇਸ ਇਸ ਸਥਾਨ 'ਤੇ ਹਰ ਰੋਜ਼ ਸਵੇਰੇ ਮੱਥਾ ਟੇਕਣ ਜਾਂਦਾ ਹਾਂ ਗੁਰਦੁਆਰੇ ਵਿੱਚ ਜਦ ਵੀ ਕੋਈ ਦਿਨ ਤਿਉਹਾਰ ਜਿਵੇਂ ਕਿ ਸੰਗਰਾਂਦ ਜਾਂ ਪੂਰਨਮਾਸੀ ਜਾਂ ਕੋਈ ਗੁਰਪੁਰਬ ਹੋਵੇ ਤਾਂ ਉਰੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹਰ ਵੇਲੇ ਉਰੇ ਸ਼ਰਧਾਲੂ ਦਰਸ਼ਨ ਕਰਨ ਲਈ ਪਹੁੰਚੇ ਹੁੰਦੇ ਹਨ